ਭਾਰਤ ਦਾ ਇਤਿਹਾਸ ਪੰਜ ਹਜ਼ਾਰ ਸਾਲ ਪੁਰਾਣਾ ਹੈ ਜਿਵੇਂ ਕਿ ਮੈਂ ਗੱਲ ਕਰਾਂ ਗੁਰੂ ਨਾਨਕ ਦੇਵ ਸਿੱਖਾਂ ਦੇ ਪਹਿਲੇ ਗੁਰੂ ਸਨ ਉਹ ਧਰਮ ਦੇ ਬਾਣੀ ਸਨ ਅਤੇ ਦੂਜੇ ਗੁਰੂ ਗੁਰੂ ਅੰਗਦ ਜੀ ਨੇ ਗੁਰਮੁਖੀ ਲਿਪੀ ਦੀ ਰਚਨਾ ਕੀਤੀ ਉਹ ਪੰਜਾਬੀ ਦੀ ਲਿਖਤੀ ਰੂਪ ਵਿੱਚ ਮੰਨੀ ਜਾਂਦੀ ਹੈ ਗੁਰੂ ਰਾ ਅਮਰਦਾਸ ਜਾਤੀ ਭੇਦ ਭਾਵ ਵਿਰੁੱਧ ਲੜਾਈ ਲੜੀ ਅਤੇ ਲੰਗਰ ਨੂੰ ਸਿੱਖ ਧਰਮ ਦੇ ਉਚਾਰਿਆ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ਗੁਰੂ ਜੇ ਮੈਂ ਗੱਲ ਕਰਾਂ ਕਿ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਗੁਰੂ ਆਦੀ ਗ੍ਰੰਥ ਸੰਕਲਨ ਕਿਤਾ ਅਤੇ ਜੇ ਮੈਂ ਗੱਲ ਕਰਾਂ ਕਿ ਗੁਰੂ ਹਰਗੋਬਿੰਦ ਸਿੰਘ ਫੌਜੀ ਸਿੱਖ ਗੁਰੂ ਸਨ ਅਤੇ ਤੇ ਗੁਰੂ ਹਰਿਕ੍ਰਿਸ਼ਨ ਸਿੱਖ ਗੁਰੂਆਂ ਦੇ ਸਭ ਤੋਂ ਛੋਟੇ ਗੁਰੂ ਸਨ ਅਤੇ ਲਾਸਟ ਗੁਰੂ ਗੁਰੂ ਗੋਬਿੰਦ ਸਿੰਘ ਜੀ ਸਨ ਜਿਵੇਂ ਕਿ ਮੈਂ ਗੱਲ ਕਰਦਾ ਹਾਂ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਮ ਤੋਂ ਸਾਡੇ ਪੰਜਾਬ ਵਿੱਚ ਪੰਜਾਬ ਦੇ ਪਠਾਨਕੋਟ ਵਿੱਚ ਇਹਨਾਂ ਦੇ ਨਾਮ ਦਾ ਇੱਕ ਸਕੂਲ ਵੀ ਜਾਣਿਆ ਜਾਂਦਾ ਹੈ ਅਤੇ ਜੇ ਮੈਂ ਗੱਲ ਕਰਾਂ ਕਿ ਸਾਡੇ ਸਵਤੰਤਰਤਾ ਅੰਦੋਲਨ ਦੇ ਕੁਝ ਵਿਸ਼ਾ ਬੇਮਿਸਾਲ ਨੇਤਾਵਾਂ ਦੇ ਨਾਮ ਕੁਛ ਇਸ ਪ੍ਰਕਾਰ ਹਨ ਰਾਮ ਪ੍ਰਸਾਦ ਚੰਦਰਸ਼ੇਖਰ ਆਜ਼ਾਦ ਭਗਤ ਸਿੰਘ ਉਧਮ ਸਿੰਘ ਆਦਿ ਕਈ ਹੋਰ ਨੇਤਾ ਹਨ ਜਿਹਨਾਂ ਦੇ ਵਿੱਚ ਮੇਰੇ ਸਭ ਤੋਂ ਦੋ ਅਹਿਮ ਭਗਤ ਸਿੰਘ ਅਤੇ ਉਧਮ ਸਿੰਘ ਜੀ ਸਨ ਉਹਨਾਂ ਨੇ ਸਾਡੇ ਦੇਸ਼ ਲਈ ਕਈ ਹੋਰ ਕੁਰਬਾਨੀਆਂ ਦਿੱਤੀਆਂ ਜਿਹਨਾਂ ਵਿੱਚੋਂ ਸ ਮੇਰਾ ਸਭ ਤੋਂ ਪਿਆਰਾ ਭਗਤ ਸਿੰਘ ਜੀ ਹਨ